ਪਹਿਲੇ ਨੰਬਰ 'ਤੇ ਮੈਂ ਨਾਂ ਲੈਣਾ ਚਾਹਾਂਗਾ ਆਂਧਰਾ ਪ੍ਰਦੇਸ਼ ਦਾ ਦੂਜੇ ਨੰਬਰ 'ਤੇ ਮੈਂ ਨਾਮ ਲੈਣਾ ਚਾਹਾਂਗਾ ਬਿਹਾਰ ਦਾ ਤੀਜੇ ਨੰਬਰ 'ਤੇ ਮੈਂ ਨਾਂ ਲੈਣਾ ਚਾਹਾਂਗਾ ਗੋਆ ਦਾ ਚੌਥੇ ਨੰਬਰ 'ਤੇ ਮੈਂ ਨਾਂ ਲੈਣਾ ਚਾਹਾਂਗਾ ਕਰਨਾਟਕਾ ਦਾ ਪੰਜਵੇਂ ਨੰਬਰ 'ਤੇ ਮੈਂ ਨਾਂ ਲੈਣਾ ਚਾਹਾਂਗਾ ਮੱਧਿਆ ਪ੍ਰਦੇਸ਼ ਦਾ